ਸ ਪੰਜਾਬੀ ਭਾਸ਼ਾ ਸਾਡੀ ਮਾਤ ਭਾਸ਼ਾ ਆ ਸਾਡੇ ਬੋਲਣ 'ਚ ਵੀ ਬਹੁਤ ਮ ਬਹੁਤ ਮਿੱਠੀ ਹੈ ਬਹੁਤ ਮਤਲਬ ਵਧ ਬਹੁਤ ਵਧੀਆ ਆ ਅਸੀਂ ਘਰ ਤੋਂ ਹੀ ਸਿੱਖੇ ਹਾਂ ਸਾਨੂੰ ਕਿਤੇ ਸਿੱਖਣ ਦੀ ਲੋੜ ਹੀ ਨਹੀਂ ਪਈ ਇਹਨੂੰ ਸਾਨੂੰ ਪੰਜਾਬੀ ਜਿੱਦਾਂ ਅਸੀਂ ਜ ਜ ਜੰਮੇ ਹਾਂ ਉਹਦੇ ਉਦੋਂ ਹੀ ਪੰਜਾਬੀ ਬੋਲਦੇ ਰਹੇ ਹੁਣ ਤੱਕ ਵੀ ਸ ਪੰਜਾਬੀ ਬੋਲੀ ਜਾਂਦੇ ਪਏ ਹਾਂ ਹੁਣ ਪਤਾ ਕੀ ਗੱਲ ਆ ਸਕੂਲਾਂ ਵਿੱਚ ਕੋਲਜਾਂ ਵਿੱਚ ਇੱਦਾਂ ਕਰਦੇ ਪਏ ਆ ਵੀ ਪੰਜਾਬੀ ਭਾਸ਼ਾ ਨੂੰ ਘੱਟ ਕੱਢ ਦਿੰਦੇ ਪਏ ਇੰਗਲਿਸ਼ ਅਤੇ ਹਿੰਦੀ ਵਿੱਚ ਜ਼ੋਰ ਦਿੰਦੇ ਪਏ ਆ ਪਰ ਸਰਕਾਰ ਨੂੰ ਚਾਹੀਦਾ ਵਾ ਵੀ ਇਹਦੇ ਵਿੱਚ ਵੀ ਫਾਈਨ ਲਾਣ ਵੀ ਜੇ ਪੰਜਾਬੀ ਭਾਸ਼ਾ ਨਾ ਹੋਵੇ ਤਾਂ ਫਾਈਨ ਲਾਣ ਵੀ ਇੱਦਾਂ ਪੰਜਾਬੀ ਭਾਸ਼ਾ ਕਿਉਂ ਪਿ ਪਿੱਛੇ ਕਰਨੀ ਅਸੀਂ ਇਹ ਤਾਂ ਜ਼ਰੂਰੀ ਆ ਬਹੁਤ ਜ਼ਰੂਰੀ ਆ ਤਾਂ ਕਰਕੇ ਹਾਂਜੀ